ਹੈਲੋ ਤੁਸੀਂ ਫਲਿਪਕਾਰਟ ਤੋਂ ਬੋਲਦੇ ਪਏ ਹੋ ਮੈਂ ਤੁਹਾਡੇ ਤੋਂ ਈਬੁੱਕਸ ਮੰਗਵਾਈਆਂ ਸੀ ਜਿਹਨਾਂ ਦਾ ਐਕਸਪੀਰੰਸ ਬਹੁਤ ਹੀ ਵਧੀਆ ਰਿਹਾ ਇਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਵਧੀਆ ਸੀ ਇਹਨਾਂ ਨੂੰ ਪੜ੍ਹ ਕੇ ਬਹੁਤ ਹੀ ਅੱਛਾ ਲੱਗ ਰਿਹਾ ਮੈਂ ਪਹਿਲਾਂ ਵੀ ਫਲਿਪਕਾਰਟ ਤੋਂ ਕਾਫ਼ੀ ਸਾਰੀਆਂ ਚੀਜ਼ਾਂ ਮੰਗਵਾਈਆਂ ਮੈਨੂੰ ਇੱਥੇ ਬਹੁਤ ਜ਼ਿਆਦਾ ਡਿਸਕਾਊਟ ਮਿਲਦਾ ਜਾ ਇਹ ਜਿਹੜੀਆਂ ਈਬੁੱਕਸ ਹੈ ਇਹਨਾਂ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਵਧੀਆ ਹੈ ਪਿਕਚਰ ਵੀ ਕਲੀਅਰਲੀ ਦਿਖਾਈ ਦੇ ਰਹੀਆਂ ਕਨਵੀਨੀਅਨਸ ਹੈ ਪੋਰਟੇਬਿਲਟੀ ਹੈ ਮਤਲਬ ਕਾਫ਼ੀ ਸਾਰੇ ਫੀਚਰਸ ਹੈ ਇਸਮੇਂ ਮੈਂ ਆਰਾਮ ਸੇ ਪੜ੍ਹ ਪਾ ਰਹੀ ਹੂੰ ਜੋ ਵੀ ਲਿਖਿਆ ਹੈ ਵੋ ਰੈਲੇਵੈਂਟ ਹੈ ਮਤਲਬ ਕੋਨਟੈਂਟ ਰੈਲੇਵੈਂਟ ਹੈ ਇਸਮੇਂ ਸਾਰਾ ਕੁਛ ਬਹੁਤ ਹੀ ਕਲੀਅਰਲੀ ਡਿਫਾਈਨਡ ਹੈ ਸਾਰਾ ਕੁਛ ਮਤਲਬ ਥਿਊਰੀ ਬਹੁਤ ਹੀ ਅੱਛੇ ਸੇ ਲਿਖੀ ਹੁਈ ਹੈ ਐਕਸਪਲੇਨ ਕੀ ਹੁਈ ਹੈ ਏਕ ਏਕ ਚੀਜ਼ ਕੋ ਡਾਇਗਰਾਮ ਕੇ ਸਾਥ ਸਮਝਾਇਆ ਗਿਆ ਤੋ ਮਤਲਬ ਮੇਰੀ ਮੁ ਮੁਝੇ ਬਹੁਤ ਹੀ ਅੱਛਾ ਲਗਾ ਇਸ ਬੁੱਕ ਕੋ ਪੜ੍ਹ ਕੇ ਧੰਨਵਾਦ